ਤਕਨੀਕੀ ਸੁਧਾਰ ਦੇ ਮਾਮਲੇ ਵਿੱਚ ਖੇਤਰ ਦੀਆਂ ਕਈ ਪ੍ਰਮੁੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰੀ ਜਿਹੜੇ ਬਜ਼ੁਰਗ ਲੋਕੀ ਹੁੰਦੇ ਹਨ ਜਾਂ ਜਿਹਨਾਂ ਨੂੰ ਤਕਨੀਕੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਹੈਗੀ ਹੈ ਉਹਨਾਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਕਿ ਨੌਜਵਾਨ ਲੋਕ ਹਨ ਉਹੀ ਤਕਨੀਕੀ ਸੁਧਾਰ ਨੂੰ ਸਮਝ ਰਹੇ ਹਨ ਉਹਨਾਂ ਦੇ ਨਾਲ ਨਾਲ ਕਦਮ ਵਧਾਉਂਦੇ ਹਨ ਤਕਨੀਕੀ ਸੁਧਾਰ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡਾ ਦੇਸ਼ ਅੱਗੇ ਵੱਧ ਰਿਹਾ ਹੈ ਅਤੇ ਬੁਲੰਦੀਆਂ ਨੂੰ ਹਾਸਿਲ ਕਰ ਰਿਹਾ ਕਈ ਵਾਰੀ ਤਕਨੀਕੀ ਕੰਮਾਂ ਵਿੱਚ ਕਈ ਮੁਸੀਬਤਾਂ ਆ ਜਾਂਦੀਆਂ ਹਨ ਜਿਵੇਂ ਕੋਈ ਕਿਸੇ ਦੇ ਅਕਾਊਂਟ ਵਿੱਚੋਂ ਪੈਸੇ ਕੱਢ ਲਵੇ ਕਿਸੇ ਦਾ ਫੋਨ ਹੈਕ ਕਰ ਲਵੇ ਅਤੇ ਉਹਦੀ ਸਾਰੀ ਜਾਣਕਾਰੀ ਕੱਢ ਲਵੇ ਇਸ ਵਿੱਚ ਕਈ ਲੋਕਾਂ ਨੂੰ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਕਈ ਵਾਰੀ ਅੰਦਰੂਨੀਆਂ ਵੀ ਹੁੰਦੀਆਂ ਨੇ ਕਈ ਵਾਰੀ ਬਾਹਰਲੀਆਂ ਵੀ ਹੁੰਦੀਆਂ ਨੇ ਤਕਨੀਕੀ ਜਿਹੜੇ ਕੰਮ ਨੇ ਬੜੇ ਧਿਆਨ ਨਾਲ ਅਤੇ ਸਮਝਦਾਰੀ ਨਾਲ ਕਰਨੇ ਚਾਹੀਦੇ ਹਨ ਅਤੇ ਇਹ ਨੌਜਵਾਨ ਪੀੜ੍ਹੀ ਜਿਹੜੀ ਇਹਨਾਂ ਨੂੰ ਚਲਾਉਂਦੀ ਪਈ ਇਹਨੂੰ ਸਮਝਦੀ ਪਈ ਹੈ ਉਹਨੂੰ ਵੀ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਤਕਨੀਕ ਨੂੰ ਆਪਣੀ ਲੋੜ ਮੁਤਾਬਕ ਹੀ ਵਰਤਣ ਜ਼ਿਆਦਾ ਇਹਦਾ ਗਲਤ ਇਸਤੇਮਾਲ ਨਾ ਕਰਨ ਧੰਨਵਾਦ